ਸਰਕਾਰ ਦੀਆਂ ਕਈ ਸਕੀਮਾਂ ਤੋਂ ਅਸੀਂ ਜਾਣੂ ਹਾਂ ਜਿਵੇਂ ਰਾਸ਼ਨ ਕਾਰਡ ਦੀ ਸਕੀਮ ਆ ਹੈ ਨਾ ਉਹ 'ਚ ਸਾਨੂੰ ਰਾਸ਼ਨ ਮਿਲਦਾ ਹੈ ਅਤੇ ਫਰੀ ਸਰਕਾਰ ਰਾਸ਼ਨ ਦਿੰਦੀ ਹੈ ਅਤੇ ਐਵੇਂ ਹੀ ਪ੍ਰਧਾਨ ਮੰਤਰੀ ਅਵਾਸ ਯੋਜਨਾ ਤਹਿਤ ਕਈ ਲਾਭਪਾਤਰੀ ਲੋਕਾਂ ਨੂੰ ਘਰ ਮਿਲੇ ਨੇ ਜੋ ਕਿ ਸਰਕਾਰ ਨੇ ਘਰ ਬਣਾ ਕੇ ਦਿੱਤੇ ਨੇ ਅਤੇ ਇੱਕ ਹੈਲਥ ਬੀਮਾ ਯੋਜਨਾ ਆਉਂਦੀ ਹੈ ਜੋ ਕਿ ਵਿਅਕਤੀ ਦੀ ਜ਼ਿੰਦਗੀ ਲਈ ਯੋਜਨਾ ਬਣਾਈ ਗਈ ਹੈ ਕਿ ਉਸਨੂੰ ਕੋਈ ਵੀ ਬਿਮਾਰੀ ਹੁੰਦੀ ਹੈ ਤਾਂ ਉਸਨੂੰ ਪੰਜ ਲੱਖ ਤੱਕ ਦਾ ਇਲਾਜ ਫਰੀ ਹੈ ਐਵੇਂ ਦੀਆਂ ਹੋਰ ਕਈ ਸਕੀਮਾਂ ਮਿਲਦੀਆਂ ਹਨ ਅਤੇ ਜਿਨ੍ਹਾਂ ਵਿੱਚੋਂ ਮੁੱਖ ਸਕੀਮਾਂ ਮੈਂ ਦੱਸੀਆਂ ਨੇ ਅਤੇ ਇਹਨਾਂ ਦਾ ਲਾਭ ਸਭ ਤੋਂ ਵ ਵੱਧ ਵਿਅਕਤੀ ਉਠਾ ਰਹੇ ਨੇ